ਹਾਂ ਸਤਿ ਸ਼੍ਰੀ ਅਕਾਲ ਬੇਟਾ ਜੀ ਹਾਂ ਬੇਟਾ ਤੁਹਾਡਾ ਘਰ ਆ ਇਹ ਹਾਂ ਬੇਟਾ ਮੈਂ ਘਰ ਨਵਾਂ ਲਿੱਤਾ ਤੁਹਾਡੇ ਨਾਲ ਹੀ ਅਤੇ ਮੈਂ ਤੁਹਾਡੀ ਹਾਂਜੀ ਮੈਂ ਤੁਹਾਡੀ ਨਵੀਂ ਪੜੋਸਨ ਆ ਅਤੇ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਥੈਂਕ ਯੂ ਬੇਟਾ ਬੇਟਾ ਮੈਂ ਨਾ ਐਕਚੁਲੀ ਬਾਹਰੋਂ ਆਈ ਹਾਂ ਅਤੇ ਮੈਂ ਨਵੀਂ ਹਾਂ ਇਸ ਸ਼ਹਿਰ ਦੇ ਵਿੱਚ ਅਤੇ ਮੈਨੂੰ ਇੱਥੋਂ ਦਾ ਕੁਛ ਪਤਾ ਨਹੀਂ ਹੈ ਟਰਾਂਸਪੋਰਟੇਸ਼ਨ ਬਾਰੇ ਤਾਂ ਥੋੜ੍ਹਾ ਮੈਨੂੰ ਗਾਈਡ ਕਰੋਗੇ ਤੁਸੀਂ ਹਾਂ ਬੇਟਾ ਹਾਂ ਬੇਟਾ ਮੈਂ ਜਲੰਧਰ ਜੋਬ ਕਰਦੀ ਹਾਂ ਔਰ ਮੇਰਾ ਰੈਜੀਡੈਂਸ ਤਾਂ ਹੁਣ ਇੱਥੇ ਹੀ ਹੈ ਅਤੇ ਮੈਂ ਉੱਥੇ ਅਗਰ ਡੇਲੀ ਅਪ ਡਾਊਨ ਕਰਨਾ ਤਾਂ ਮੈਂ ਕਿਸ ਤਰੀਕੇ ਨਾਲ ਜਾ ਸਕਦੀ ਹਾਂ ਹਮ ਹਮ ਹਮ ਹਮ ਹਮ ਹਮ ਠੀਕ ਹੈ ਠੀਕ ਹੈ ਅੱਛਾ ਪਾਸ ਵੀ ਬਣ ਜਾਂਦੇ ਹੈ ਹਾਂ

ਠੀਕ ਹੈ ਇਹ ਤਾਂ ਬਹੁਤ ਵਧੀਆ ਗੱਲ ਹੈ ਤਾਂ ਬੇਟਾ ਅਗਰ ਮੈਂ ਦਿੱਲੀ ਜਾਂ ਚੰਡੀਗੜ੍ਹ ਜਾਣਾ ਇੱਥੇ ਫਿਰ ਵੀ ਬੱਸ 'ਚ ਜਾਣਾ ਪਏਗਾ ਜੇ ਉੱਥੇ ਰੇਲਵੇ ਸਟੇਸ਼ਨ ਵੀ ਕੋਲ ਹੈ ਕੋਈ ਠੀਕ ਹੈ ਇਹ ਤਾਂ ਬਹੁਤ ਵਧੀਆ ਗੱਲ ਹੈ ਤਾਂ ਉੱਥੇ ਵੀ ਜਾ ਕੇ ਤੁਹਾਨੂੰ ਟਿਕਟ ਉਸ ਵੇਲੇ ਓਨ ਦਾ ਸਪੋਰਟ ਮਿਲ ਜਾਂਦੀ ਆ ਜਾਂ ਉੱਥੇ ਜਾ ਕੇ ਬੁੱਕ ਕਰਵਾਉਣੀ ਪੈਂਦੀ ਹੈ ਜਾਂ ਫਿਰ ਅਸੀਂ ਪਹਿਲਾਂ ਹੀ ਬੁੱਕ ਕਰਵਾ ਸਕਦੇ ਹਾਂ ਔਨਲਾਈਨ ਵੀ ਹਾਂਜੀ ਹਮ ਹਮ ਠੀਕ ਹੈ ਬੇਟਾ ਤੁਸੀਂ ਬਹੁਤ ਵਧੀਆ ਗਾਈਡ ਕੀਤਾ ਮੈਨੂੰ ਔਰ ਬੇਟਾ ਇੱਕ ਹੋਰ ਚੀਜ਼ ਪੁੱਛਣੀ ਸੀ ਮੈਂ ਅਗਰ ਮੈਂ ਲੋਕਲ ਇੱਥੇ ਹੁਣ ਜਿਸ ਤਰ੍ਹਾਂ ਛੁੱਟੀ ਵਾਲੇ ਦਿਨ ਮੈਂ ਲੋਕਲ ਵੀ ਘੁੰਮਣਾ ਚਾਹੁੰਦੀ ਹਾਂ ਮੈਂ ਦੇਖਣਾ ਚਾਹੁੰਦੀ ਹਾਂ ਕਿ ਆਸ ਪਾਸ ਦੇ ਕਈ ਟੂਰਿਸਟ ਏਰੀਆ ਹੈਗੇ ਆ ਜਾਂ ਦੇਖਣ ਵਾਸਤੇ ਕੋਈ ਜਗ੍ਹਾ ਉਹ ਵੀ ਥੋੜ੍ਹਾ ਗਾਈਡ ਕਰ ਦਿਉ ਕਿ ਕਿਹੜੀ ਕਿਹੜੀ ਹੈਗੀ ਆ ਅਤੇ ਕਿਸ ਤਰ੍ਹਾਂ ਅਸੀਂ ਜਾਵਾਂਗੇ ਜਿਸ ਤਰ੍ਹਾਂ ਅਸੀਂ ਗੋਲਡਨ ਟੈਂਪਲ ਜਾਣਾ ਤਾਂ ਉਹ ਵੀ ਈ ਰਿਕਸ਼ਾ ਚਲੇ ਜਾਂਦੇ ਉੱਥੋਂ ਤੱਕ ਅੱਛਾ ਅੱਛਾ ਇੱਕ ਮੈਂ ਸੁਣਿਆ ਇੱਥੇ ਕਿ ਦੁਰਗਿਆਨਾ ਮੰਦਿਰ ਵੀ ਹੈ ਅਤੇ ਉਹਦੇ 'ਤੇ ਜਾਣ ਵਾਸਤੇ ਵੀ ਅੱਛਾ ਵੀ ਈ ਰਿਕਸ਼ਾ ਮਿਲ ਜਾਏਗਾ ਅਤੇ ਕੈਬ ਵਗੈਰਾ ਕਰਨੀ ਹੋਵੇ ਤਾਂ ਉਹ ਵੀ ਬੁੱਕ ਹੋ ਜਾਵੇਗੀ ਇੱਥੋਂ ਠੀਕ ਹੈ ਬੇਟਾ ਬਹੁਤ ਥੈਂਕ ਯੂ ਤੁਹਾਡਾ ਤੁਸੀਂ ਮੈਨੂੰ ਗਾਈਡ ਕੀਤਾ ਅੱਗੋਂ ਵੀ ਲੋੜ ਪਏਗੀ ਤਾਂ ਮੈਂ ਤੁਹਾਡੀ ਹੈਲਪ ਲਵਾਂਗੀ ਜੀ ਠੀਕ ਹੈ ਜੀ ਓਕੇ ਬੇਟਾ ਥੈਂਕ ਯੂ ਬੱਚੇ